ਹਾਂ ਅਜਿਹਾ ਰੂੁਟ ਤਾਂ ਹੈ ਜਿੱਥੇ ਬੱਸਾਂ ਟਰੇਨਾਂ ਵਿੱਚ ਹਮੇਸ਼ਾ ਭੀੜ ਹੀ ਭੀੜ ਰਹਿੰਦੀ ਹੈ ਜਦੋਂ ਆਪਾਂ ਕਿਤੇ ਯੂਪੀ ਬਿਹਾਰ ਵਾਲੀ ਸਾਈਡ ਜਾਣਾ ਹੋਵੇ ਤਾਂ ਸਾਨੂੰ ਪਹਿਲੇ ਬੁਕਿੰਗ ਕਰਵਾਉਣੀ ਪੈਂਦੀ ਹੈ ਅਗਰ ਸਾਨੂੰ ਐਮਰਜੈਂਸੀ ਪੈ ਜਾਵੇ ਤਾਂ ਉੱਥੇ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਹੈ ਟਰੇਨਾਂ ਵਿੱਚ ਬੈਠਣ ਦੀ ਵੀ ਜਗ੍ਹਾ ਨਹੀਂ ਹੁੰਦੀ ਚਲੋ ਉਸ ਜਗ੍ਹਾ 'ਤੇ ਬੱਸ ਤਾਂ ਜਾਂਦੀ ਹੀ ਨਹੀਂ ਹੈ ਪਰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਸੀਟ ਨਹੀਂ ਮਿਲਦੀ ਧੱਕਾ ਮੁੱਕੀ ਹੁੰਦੀ ਹੈ ਬਹੁਤ ਹੀ ਤਰ੍ਹਾਂ ਦੀ ਸਮੱਸਿਆਵਾਂ ਇੱਕ ਤਰ੍ਹਾਂ ਦੀ ਪੈਂਦਾ ਹੋ ਜਾਂਦੀਆਂ ਹਨ ਯਾਤਰਾ ਵਿੱਚ ਸਮੱਸਿਆਵਾਂ ਕਈ ਤਰ੍ਹਾਂ ਦੀ ਪੈਦਾ ਹੁੰਦੀਆਂ ਹਨ ਕਿਉਂ ਜਦੋਂ ਆਪਾਂ ਕਿਸੇ ਤਿਉਹਾਰ ਦੇ ਟਾਈਮ 'ਤੇ ਅਗਰ ਆਪਾਂ ਬਾਹਰ ਜਾਂਦੇ ਹਾਂ ਤਿਉਹਾਰ ਦੇ ਸਮੇਂ ਵਿੱਚ ਆਪਾਂ ਬਾਹਰ ਜਾਂਦੇ ਹਾਂ ਅਤੇ ਸਾਨੂੰ ਜਿਵੇਂ ਕਿ ਉੱਥੇ ਜਾ ਕੇ ਸਾਨੂੰ ਕਮਰੇ ਵਗੈਰਾ ਨਹੀਂ ਮਿਲਦੇ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਹੁੰਦੀਆਂ ਹਨ ਜਿਵੇਂ ਕਿ ਉੱਥੇ ਅਗਰ ਆਪਾਂ ਤਿਉਹਾਰ ਦੇ ਟਾਈਮ ਜਾਂਦੇ ਹਾਂ ਸਾਨੂੰ ਜਗ੍ਹਾ ਨਹੀਂ ਪਤਾ ਚੱਲਦੀ ਕਿ ਸਾਨੂੰ ਕਿਸ ਜਗ੍ਹਾ 'ਤੇ ਜਾਣਾ ਚਾਹੀਦਾ ਹੈ ਸਾਨੂੰ ਕਮਰੇ ਨਹੀਂ ਮਿਲਦੇ ਸਾਨੂੰ ਖਾਂ ਅ ਸਾਨੂੰ ਸਾਧਨ ਨਹੀਂ ਮਿਲਦੇ ਕਿ ਕਿਸ ਜਗ੍ਹਾ 'ਤੇ ਅਤੇ ਉੱਥੇ ਦੇ ਲੋਕ ਕੀ ਕਰਦੇ ਹਨ ਕਿ ਅਗਰ ਤਾਂ ਕੋਈ ਬਾਹਰਲਾ ਕਿਸੇ ਬੰਦੇ ਨੂੰ ਦੇਖ ਲੈਣ ਤਾਂ ਫਿਰ ਬਹੁਤ ਜ਼ਿਆਦਾ ਪੈਸੇ ਵਗੈਰਾ ਲੈਂਦੇ ਹਨ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਗਰ ਤਾਂ ਜ਼ਿਆਦਾ ਰਸ਼ ਹੈਗਾ ਟਰੇਨਾਂ ਵਿੱਚ ਤਾਂ ਸਾਨੂੰ ਆਪਣੇ ਬੈਗਾਂ ਦਾ ਸਭ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਅਗਰ ਨਾ ਰੱਖਾਂਗੇ ਤਾਂ ਕੋਈ ਵੀ ਸਾਨੂੰ ਨਹੀਂ ਪਤਾ ਹੁੰਦਾ ਸਾਡੇ ਨਾਲ ਬੈਠਾ ਹੋਇਆ ਵੀ ਕਿਸ ਤਰ੍ਹਾਂ ਦਾ ਇਨਸਾਨ ਹੈਗਾ ਉਹ ਕੁਛ ਵੀ ਕਰ ਸਕਦਾ ਹੈ ਸਾਡੇ ਨਾਲ ਇਸ ਲਈ ਆਪਣੀ ਹੀ ਸੁਰਕਸ਼ਾ ਸਭ ਤੋਂ ਪਹਿਲੇ ਰੱਖਣੀ ਚਾਹੀਦੀ ਹੈ ਹੈ ਅਤੇ ਇਹੀ ਬਹੁਤ ਸਾਰੀਆਂ ਸਮੱਸਿਆਵਾਂ ਜੋ ਪੈਦਾ ਹੰਦੀਆਂ ਹਨ